ਹਾਂਜੀ ਕੁਝ ਵਿਲੱਖਣ ਪਕਵਾਨ ਜਿਵੇਂ ਕਿ ਮਨਚੂਰੀਅਨ ਡੋਸਾ ਪਾਓ ਭਾਜੀ ਆਦਿ ਇਹਨਾਂ ਨੂੰ ਪਕਾਉਣ ਵਿੱਚ ਮਸਾਲੇ ਦੀ ਅਹਿਮ ਵਰਤੋਂ ਕੀਤੀ ਜਾਂਦੀ ਹੈ ਮਸਾਲਾ ਇਹਨਾਂ ਦਾ ਇੱਕ ਅਹਿਮ ਹਿੱਸਾ ਹੈ ਇਸ ਤੋਂ ਬਿਨਾ ਇਸ ਨੂੰ ਤਿਆਰ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਸਾਲਾ ਹੀ ਅਸਲ ਵਿੱਚ ਇਹਨਾਂ ਦਾ ਟੇਸਟ ਸਵਾਦ ਬਣਾਉਂਦਾ ਹੈ ਜਦੋਂ ਇਹ ਬੇ ਜਦੋਂ ਇਹ ਬੇਸਿਕਲੀ ਤਿਆਰ ਕੀਤੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਮਸਾਲੇ ਦਿਆ ਨਾਲ ਹੀ ਤਿਆਰ ਕੀਤਾ ਜਾਂਦਾ ਹੈ ਮਸਾਲੇ ਪਾਉਣੇ ਇਹਨਾਂ ਵਿੱਚ ਬਹੁਤ ਜ਼ਰੂਰੀ ਹਨ ਹੋਰ ਚੀਜ਼ਾਂ ਵਿੱਚ ਵੀ ਮਸਾਲੇ ਪੈਂਦੇ ਹਨ ਪਰ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਮਸਾਲੇ ਪੈਂਦੇ ਹਨ ਇਹ ਪਕਵਾਨ ਤਿਆਰ ਹੀ ਤਾਂ ਹੁੰਦੇ ਹਨ ਜਦੋਂ ਇਹਨਾਂ ਵਿੱਚ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਮਸਾਲਿਆਂ ਤੋਂ ਬਿਨਾ ਇਹ ਕੁਛ ਵੀ ਨਹੀਂ ਹਨ